ਆਪਣੀ ਆਵਾਜ਼ ਨੂੰ ਠੀਕ ਰੱਖਣ ਦੇ ਲਈ ਮੈਂ ਹਮੇਸ਼ਾ ਕੋਸਾ ਪਾਣੀ ਪੀਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਦੂਸਰਾ ਜਿਹੜਾ ਹੈ ਮੇਰੀ ਜਿਹੜਾ ਧਿਆਨ ਇਸ ਚੀਜ਼ ਵੱਲ ਹੁੰਦਾ ਏ ਕਿ ਕੋਈ ਵੀ ਖੱਟੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਾ ਖਾਦੀਆਂ ਜਾਣ ਜਿਵੇਂ ਆਪਾਂ ਕਹਿ ਸਕਦੇ ਹਾਂ ਕੋਈ ਚੱਟਣੀਆਂ ਹੋਗੀਆਂ ਜਾਂ ਸੌਸ ਹੋ ਗਏ ਉਹਨਾਂ ਦੀ ਵਰਤੋਂ ਜਿਹੜੀ ਉਹ ਘੱਟ ਕੀਤੀ ਜਾਵੇ ਅਤੇ ਆਪਣੀ ਆਵਾਜ਼ ਦੀ ਸੁਰੱਖਿਆ ਦੇ ਵਾਸਤੇ ਜੇ ਆਪਾਂ ਆਪਣੇ ਥੋੜ੍ਹਾ ਬਹੁਤ ਇਹ ਕਰ ਸਕੀਏ ਕਿ ਜਿਵੇਂ ਆਪਾਂ ਗਰਾਰੇ ਕਰਦੇ ਹਾਂ ਨਾ ਗਾਰਗਲਸ ਕਰਦੇ ਹਾਂ ਉਹ ਕਰ ਲਈਏ ਤਾਂ ਉਹਦੇ ਨਾਲ ਵੀ ਸਾਡੀ ਜਿਹੜੀ ਆਵਾਜ਼ ਹੈ ਉਹ ਠੀਕ ਰਹਿੰਦੀ ਆ ਇਸ ਲਈ ਮੈਂ ਇਹ ਕੁਝ ਜਿਹੜੀਆਂ ਟਕਨੀਕਸ ਆ ਉਹ ਯੂਜ਼ ਕਰਦੀ ਹਾਂ ਤਾਂ ਕਿ ਮੇਰੀ ਜਿਹੜੀ ਆਵਾਜ਼ ਹੈ ਉਹ ਠੀਕ ਰਹਿ ਸਕੇ